ਮੈਂ ਆਪ ਜੀ ਦੇ ਰੈਸਟੋਰੋਂਟ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਮੇਂ ਸਿਰ ਮੇਰਾ ਬਾਰਿਸ਼ ਦੇ ਮੌਸਮ ਵਿੱਚ ਭੋਜਨ ਭੋਜਨ ਪਹੁੰਚਾਇਆ ਤੁਸੀਂ ਮੇਰਾ ਓਡਰ ਕੈਂਸਲ ਨਹੀਂ ਕੀਤਾ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹਾਂ ਵੈਸੇ ਤਾਂ ਬਾਰਿਸ਼ ਦੇ ਮੌਸਮ ਵਿੱਚ ਸਭ ਨੇ ਭੋਜਨ ਪਹੁੰਚਾਉਣ ਤੋਂ ਮਨ੍ਹਾ ਕਰ ਦਿੱਤਾ ਪਰ ਤੁਹਾਡੀ ਡਿਲੀਵਰੀ ਬਹੁਤ ਤੇਜ਼ ਅਤੇ ਭੋਜਨ ਵੀ ਇੱਕ ਦਮ ਗਰਮ ਸੀ ਇਸ ਲਈ ਮੈਂ ਤੁਹਾਡੇ ਰੈਸਟੋਰੋਂਟ ਦਾ ਨਾਮ ਸਾਰਿਆਂ ਨੂੰ ਦੱਸੂੰਗੀ ਅਤੇ ਤੁਹਾਨੂੰ ਚਾਰ ਤਾਰਿਆਂ ਨਾਲ ਸਨਮਾਨਿਤ ਕਰੂੰਗੀ ਸਨਮਾਨਿਤ ਕਰੂੰਗੀ ਅਤੇ ਤੁਹਾਡੀ ਜਗ੍ਹਾ ਬਾਰੇ ਸਭ ਲੋਕਾਂ ਨੂੰ ਦੱਸੂੰਗੀ